ਭੰਗੜਾ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ ਇਸ ਨੂੰ ਅੱਠ ਜਾਂ ਦਸ ਲੋਕਾਂ ਦੇ ਸਮੂਹ ਵਿੱਚ ਕੀਤਾ ਜਾਂਦਾ ਹੈ ਕੁਝ ਲੋਕਾਂ ਦੀਆਂ ਇਸ ਬਾਰੇ ਗਲਤ ਧਾਰਨਾਵਾਂ ਹਨ ਜਿਵੇਂ ਕਿ ਇਸ ਵਿੱਚ ਰੌਲਾ ਰੱਪਾ ਅਤੇ ਉਛਲ ਕੁੱਦ ਨਜਾਇਜ਼ ਹੀ ਕਰੀ ਜਾਂਦੇ ਹਨ ਜਦੋਂ ਕਿ ਸੱਚਾਈ ਇਹ ਨਹੀਂ ਹੈ ਇਹ ਇੱਕ ਪ੍ਰਸਿੱਧ ਨਾਚ ਹੀ ਨਹੀਂ ਹੈ ਜਦੋਂ ਕਿ ਇਹ ਇਕ ਮਨੋਰੰਜਨ ਦਾ ਸਾਧਨ ਵੀ ਹੈ ਭੰਗੜਾ ਨੂੰ ਕਰਨ ਵਿੱਚ ਕੁਝ ਚੀਜ਼ਾਂ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ ਜਿਵੇਂ ਕਿ ਢੋਲ ਚਿਮਟਾ ਸਰੰਗੀ ਖੂੰਡਾ ਅਤੇ ਕੈਂਚੀ ਆਦਿ ਭੰਗੜਾ ਇੱਕ ਮਨ ਦੀਆਂ ਭਾਵਨਾਵਾਂ ਨੂੰ ਦਰਸਾਉਣ ਦਾ ਤਰੀਕਾ ਹੈ ਇਸ ਵਿੱਚ ਹੱਥਾਂ ਦੇ ਮੋਢੇ ਦੇ ਪੈਰਾਂ ਦੇ ਅਤੇ ਗਰਦਨ ਨੂੰ ਮਟਕਾ ਕੇ ਭਾਵਨਾਵਾਂ ਨੂੰ ਦਰਸਾਇਆ ਜਾਂਦਾ ਹੈ ਜਦੋਂ ਢੋਲ 'ਤੇ ਥਾਤ ਲੱਗਦੀ ਹੈ ਤਾਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੇ ਅੰਗਾਂ ਵਿੱਚ ਥਿਰਕਣ ਪੈਦਾ ਹੁੰਦੀ ਹੈ ਇਹ ਇੱਕ ਮਾਨਸਿਕ ਅਤੇ ਸਰੀਰਕ ਤੌਰ 'ਤੇ ਕਸਰਤ ਵੀ ਹੈ ਭੰਗੜਾ ਇਨਸਾਨ ਨੂੰ ਮਾਨਸਿਕ ਵਿਕਾਰਾਂ ਤੋਂ ਦੂਰ ਰੱਖਦਾ ਹੈ ਕੁਝ ਲੋਕਾਂ ਦੀ ਭੰਗੜੇ ਬਾਰੇ ਗਲਤ ਧਾਰਨਾ ਇਸ ਦੀਆਂ ਖੂਬੀਆਂ ਦੱਸ ਕੇ ਹੀ ਦੂਰ ਕੀਤੀ ਜਾ ਸਕਦੀ ਹੈ ਧੰਨਵਾਦ